ਪੰਛੀਆਂ ਦੇ ਵਰਤਾਅ ਦੇ ਬਾਰੇ ਮੈਂ ਇੱਕ ਵਿਚਾਰ ਸ ਜਾਂ ਆਪਣਾ ਤਜ਼ੁਰਬਾ ਸਾਂਝਾ ਕਰਨਾ ਚਾਹੁੰਦੀ ਹਾਂ ਮੈਨੂੰ ਇਹ ਲੱਗਦਾ ਹੈ ਕਿ ਹਰ ਪੰਛੀ ਆਪਣੇ ਕਿਸੇ ਨਾ ਕਿਸੇ ਕਾਰਨਵਸ਼ ਕਿਸੇ ਨਾ ਕਿਸੇ ਤਰੀਕੇ ਦੇ ਸੁਭਾਅ ਜਾਂ ਵਰਤਾਅ ਸਾਡੇ ਸਾਹਮਣੇ ਪੇਸ਼ ਕਰਦਾ ਹੈ ਇਸੇ ਤਰ੍ਹਾਂ ਦੀ ਇੱਕ ਗੱਲ ਹੈ ਕਿ ਬਚਪਨ ਦੇ ਵਿੱਚ ਇੱਕ ਵਾਰੀ ਮੈਂ ਆਪਣੀ ਨਾਨੀ ਘਰ ਗਈ ਓਥੇ ਮੈਂ ਵਿਹੜੇ ਵਿੱਚ ਬੈਠ ਕੇ ਸਰਦੀਆਂ ਦੇ ਵਿੱਚ ਧੁੱਪ ਸੇਕ ਰਹੀ ਸੀ ਬਹੁਤ ਸਾਰੇ ਕਾਂ ਉੱਥੇ ਉੱਡ ਰਹੇ ਸੀ ਅਤੇ ਮੈਂ ਇਹ ਸੋਚ ਰਹੀ ਸੀ ਕਿ ਇੰਨੇ ਸਾਰੇ ਕਾਂ ਕਾਂ ਕਾਂ ਕਰਕੇ ਉੱਚੀ ਉੱਚੀ ਕਿਉਂ ਬੋਲ ਰਹੇ ਹਨ ਉਹ ਬਹੁਤ ਸਾਰੇ ਝੁੰਡ ਵਿੱਚ ਇਕੱਠੇ ਹੋਏ ਹੋਏ ਸੀਗੇ ਅਤੇ ਮੈਂ ਦੇਖਿਆ ਕਿ ਮੈਂ ਅਰਾਮ ਨਾਲ ਧੁੱਪ ਸੇਕ ਰਹੀ ਸੀ ਅਤੇ ਇੰਨੇ ਦੇ ਵਿੱਚ ਦੋ ਤਿੰਨ ਕਾਂ ਆਏ ਅਤੇ ਮੇਰੇ ਸਿਰ ਦੇ ਉੱਤੇ ਆ ਕੇ ਠੂੰਗੇ ਮਾਰਨ ਲੱਗ ਗਏ ਮੈਂ ਜ਼ੋਰ ਦੀ ਰੋਣ ਲੱਗ ਗਈ ਅਤੇ ਫਟਾ ਫਟ ਡਰ ਕੇ ਅੰਦਰ ਆਪਣੀ ਮਾਤਾ ਜੀ ਕੋਲ ਭੱਜ ਗਈ ਮੈਂ ਆਪਣੇ ਮਾਤਾ ਜੀ ਨੂੰ ਪੁੱਛਿਆ ਕਿ ਇਹ ਕੀ ਗੱਲ ਹੋਈ ਮੇਰੇ ਸਿਰ 'ਤੇ ਕਾਂ ਨੇ ਠੂੰਗੇ ਕਿਉਂ ਮਾਰੇ ਤਾਂ ਫਿਰ ਮੇਰੀ ਮਾਤਾ ਜੀ ਨੇ ਦੱਸਿਆ ਕਿ ਜਦੋਂ ਵੀ ਕਾਂ ਗੁੱਸੇ ਵਿੱਚ ਹੁੰਦੇ ਹਨ ਅਤੇ ਉਹ ਇਸੇ ਤਰ੍ਹਾਂ ਵਰਤਾਅ ਕਰਦੇ ਹਨ ਮੈਂ ਬਹੁਤ ਹੈਰਾਨ ਹੋਈ ਕਿ ਕਾਵਾਂ ਨੂੰ ਵੀ ਗੁੱਸਾ ਆਉਂਦਾ ਹੈ ਤਾਂ ਮੇਰੇ ਮਾਤਾ ਜੀ ਨੇ ਕਿਹਾ ਕਿ ਹਾਂ ਉਨ੍ਹਾਂ ਦੇ ਨਾਲ ਵੀ ਜਦੋਂ ਉਨ੍ਹਾਂ ਦੇ ਝੁੰਡ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਗੱਲ ਹੋਵੇ ਕੋਈ ਲੜਾਈ ਹੋਵੇ ਕੋਈ ਝਗੜਾ ਹੋਵੇ ਤਾਂ ਉਹ ਵੀ ਇਸੇ ਤਰ੍ਹਾਂ ਆਪਣਾ ਗੁੱਸਾ ਦਰਸਾਉਂਦੇ ਹਨ ਤਾਂ ਮੈਂ ਇਹ ਗੱਲ ਸੋਚ ਕੇ ਬੜੀ ਹੈਰਾਨ ਹੋ ਗਈ ਧੰਨਵਾਦ